ਮੈਂ ਆਪਣੇ ਭਰਾ ਨੂੰ ਚੰਗੀ ਜਿਹੜੀ ਸਿੱਖਿਆ ਦਿਵਾਉਣੀ ਚਾਹੁੰਦੀ ਹਾਂ ਉਹਨੂੰ ਪ੍ਰੋਫੈਸ਼ਨਲ ਡਿਗਰੀਸ ਕਰਵਾਉਣੀ ਚਾਹੁੰਦੀ ਹਾਂ ਤਾਂ ਜੋ ਪ੍ਰੋਫੈਸ਼ਨਲ ਡਿਗਰੀਜ਼ ਦੇ ਨਾਲ਼ ਉਹ ਆਪਣੀ ਚੰਗੀ ਜੋਬ ਲੈ ਸਕੇ ਉਹਨੂੰ ਗੱਲਬਾਤ ਕਰਨ ਦਾ ਜਿਹੜਾ ਤਰੀਕਾ ਆਵੇ ਉਹ ਲੋਕਾਂ ਦੇ ਵਿੱਚ ਵਿਚਰੇ ਚੰਗੇ ਜਿਹੜੇ ਕੰਮ ਕਰੇ ਵੱਡਿਆਂ ਦਾ ਸਤਿਕਾਰ ਕਰੇ ਜਿਹੜੀ ਉਹਦੀ ਐਵੇਂ ਦੀ ਜਿਹੜੀ ਉਹਦੀ ਐਜੂਕੇਸ਼ਨ ਸਿੱਖਿਆ ਮੈਂ ਪੂਰੀ ਕਰਵਾਉਣੀ ਚਾਹੁੰਦੀ ਹਾਂ ਸਿਰਫ਼ ਜੋਬ ਤੱਕ ਹੀ ਨਹੀਂ ਜਿਹੜੀ ਮਤਲਬ ਉਹਨੂੰ ਸਲੀਕਾ ਦੇਵੇ ਜ਼ਿੰਦਗੀ ਜਿਊਣ ਦਾ ਵੀ ਜ਼ਿੰਦਗੀ ਨੂੰ ਕਿਵੇਂ ਜਿਊਣਾ ਕਿਵੇਂ ਉਹਨੇ ਲੋਕਾਂ ਦੀ ਹੈਲਪ ਕਰਨੀ ਹੈ ਕਿਵੇਂ ਉਹਨੇ ਜ਼ਿੰਦਗੀ ਦੇ ਵਿੱਚ ਸਰਵਾਈਵ ਕਰਨਾ ਮੈਂ ਐਵੇਂ ਦੀ ਜਿਹੜੀ ਪ੍ਰੋਫੈਸ਼ਨਲ ਡਿਗਰੀ ਜਿਹੜੀ ਐਜੂਕੇਸ਼ਨ ਸਿੱਖਿਆ ਉਹਨੂੰ ਪੂਰੀ ਕਰਵਾਉਣੀ ਚਾਹੁੰਦੀ ਹਾਂ ਜਿਹਦੇ ਨਾਲ਼ ਉਹ ਸਕ ਜਿਹੜੀ ਉਹਦੇ ਲਾਈਫ਼ ਦੇ ਵਿੱਚ ਕੰਮ ਵੀ ਆ ਸਕੇ